ਹੈਲੋ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਗੁਰਮੀਤ ਮਾਨੋਵਾਲ ਤੋਂ ਬੋਲ ਰਿਹਾ ਮੈਂ ਤੁਹਾਡੀ ਔਲਾ ਕੈਬ ਬੁੱਕ ਕੀਤੀ ਸੀ ਮਾਨੋਵਾਲ ਤੋਂ ਅੰਮ੍ਰਿਤਸਰ ਜਾਣ ਵਾਸਤੇ ਜਿਸ ਵੇਲੇ ਮੈਂ ਅੰਮ੍ਰਿਤਸਰ ਪਹੁੰਚ ਕੇ ਉਤਰਿਆ ਤਾਂ ਮੈਨੂੰ ਬੈਗ ਲੈਣਾ ਭੁੱਲ ਗਿਆ ਜੋ ਤੁਹਾਡੀ ਕੈਬ ਦੇ ਵਿੱਚ ਹੀ ਰਹਿ ਗਿਆ ਹੈ ਕਿਰਪਾ ਕਰਕੇ ਮੇਰਾ ਬੈਗ ਮੈਨੂੰ ਭੇਜ ਦੇਵੋ ਮੇਰਾ ਮੋਬਾਇਲ ਨੰਬਰ ਅਠਾਨਵੇਂ ਅੱਠ ਬਿਆਸੀ ਜੀਰੋ ਅਠਾਰਾਂ ਇਕੱਤੀ ਹੈ ਇਸ ਦੇ ਵਿੱਚ ਮੇਰੇ ਜ਼ਰੂਰੀ ਕਾਗਜ਼ਾਤ ਅਤੇ ਆਈ ਡੀ ਪਰੂਫ ਹੈ ਅਤੇ ਹੋਰ ਵੀ ਕੁਝ ਜ਼ਰੂਰੀ ਸਮਾਨ ਹੈ ਜਿਸ ਨੂੰ ਆਪ ਮੇਰੇ ਪਤੇ 'ਤੇ ਭੇਜ ਦੇਵੋ ਜਾਂ ਮੈਨੂੰ ਆਪਣਾ ਪਤਾ ਦੱਸੋ ਮੈਂ ਕਿਸ ਜਗ੍ਹਾ 'ਤੇ ਆਣ ਕੇ ਤੁਹਾਡੇ ਕੋਲੋਂ ਉਹ ਲੈ ਸਕਦਾ ਹਾਂ ਇਸ ਲਈ ਮੈਨੂੰ ਦੁਬਾਰਾ ਫੋਨ 'ਤੇ ਕੋਂਟੈਕਟ ਕਰੋ

ਮੇਰਾ ਸਮਾਂ ਜ਼ਿਆਦਾ ਖ਼ਰਾਬ ਨਾ ਹੋਵੇ ਅਤੇ ਮੈਨੂੰ ਮੇਰਾ ਬੈਗ ਮਿਲ ਜਾਵੇ ਤਾਂ ਕਿ ਮੈਂ ਆਪਣੇ ਬਾਕੀ ਦੇ ਕੰਮ ਜਿਹੜੇ ਹੈ ਉਹ ਟਾਈਮ ਸਿਰ ਕਰ ਸਕਾਂ ਧੰਨਵਾਦ